ਸਤਿ ਸ਼੍ਰੀ ਅਕਾਲ ਮੈਂ ਅੰਸ਼ ਮਹਾਜਨ ਪਠਾਨਕੋਟ ਸ਼ਹਿਰ ਦਾ ਰਹਿਣ ਵਾਲਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਦਾ ਖਿਡਾ ਵੀ ਹਾਰ ਜਿੱਤ ਦੇ ਕਾਰਣ ਬਹੁਤ ਹੀ ਛੇਤੀ ਨਿਰਾਸ਼ ਹੋ ਜਾਂਦੇ ਨੇ ਪਰ ਇਹ ਨਿਰਾਸ਼ਾ ਨੂੰ ਦੂਰ ਕਰਨ ਵਾਸਤੇ ਮੈਂ ਕੁਝ ਨੁਸਖੇ ਲੈ ਕੇ ਆਇਆ ਹਾਂ ਜਿਵੇਂ ਕਿ ਖਿਡਾਰੀ ਨੂੰ ਆਪਣੇ ਦਿਨ ਦੀ ਡਾਇਟ ਸਟਿਕਲੀ ਫੋਲੋ ਕਰਨੀ ਚਾਹੀਦੀ ਹੈ ਉਸ ਦੇ ਨਾਲ ਬੰਦੇ ਦਾ ਮਨ ਵੀ ਠੀਕ ਰਹਿੰਦਾ ਉਹਦੀ ਸਿਹਤ ਵੀ ਠੀਕ ਰਹਿੰਦੀ ਹੈ ਅਤੇ ਉਹ ਖੇਡ ਵਿੱਚ ਵੀ ਬਿਲਕੁਲ ਸਹੀ ਰੁਚੀ ਲੈਂਦਾ ਹੈ ਦੂਸਰੀ ਚੀਜ਼ ਹੈ ਖਿਡਾਰੀ ਨੂੰ ਆਪਣੀ ਦਿਨ ਦੀ ਕਸਰਤ ਬਿਲਕੁਲ ਸਹੀ ਤਰੀਕੇ ਨਾਲ ਕਰਨੀ ਚਾਹੀਦੀ ਹੈ ਇਸ ਨਾਲ ਉਹ ਪੂਰਾ ਫਿੱਟ ਰਹਿੰਦਾ ਹੈ ਅਤੇ ਖੇਡ ਵਿੱਚ ਵੀ ਬਿਲਕੁਲ ਸਹੀ ਤਰੀਕੇ ਨਾਲ ਖੇਡਦਾ ਹੈ ਅਤੇ ਤੀਸਰੀ ਚੀਜ਼ ਜਿਹੜੀ ਹੈ ਉਹ ਹੈ ਕਿ ਇੱਕ ਖਿਡਾਰੀ ਨੂੰ ਕਦੇ ਵੀ ਜਿੱਤ ਕੇ ਆਪਣੇ ਉੱਤੇ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਜੇ ਬੰਦਾ ਹੰਕਾਰ ਕਰ ਲਏ ਅਤੇ ਉਹ ਉਹਦੇ ਵਾਸਤੇ ਹੀ ਮਾੜਾ ਹੁੰਦਾ ਹੈ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਿ ਪਿਛਲੇ ਦੋ ਹਜ਼ਾਰ ਤੇਈ ਦੇ ਵਰਲਡ ਕੱਪ ਆਈ ਪੀ ਐਲ ਵਿੱਚ ਸਾਡਾ ਇੰਡੀਆ ਦਸ ਮੈਚ ਤਾਂ ਜਿੱਤ ਗਿਆ ਪਰ ਲਾਸਟ ਵਾਲਾ ਆਖਰੀ ਵਰਲਡ ਕੱਪ ਦਾ ਫਾਈਨਲ ਮੈਚ ਹਾਰ ਗਿਆ ਉਹ ਉਹਨਾਂ ਦਾ ਹੰਕਾਰ ਹੀ ਸੀ ਅਤੇ ਬੰਦੇ ਨੂੰ ਕਦੇ ਹਾਰ ਕੇ ਨਿਰਾਸ਼ ਵੀ ਨਹੀਂ ਹੋਣਾ ਚਾਹੀਦਾ ਉਹਨੂੰ ਹਮੇਸ਼ਾ ਹਾਰ ਜਿੱਤ ਨੂੰ ਸਵੀਕਾਰ ਕਰਨਾ ਚਾਹੀਦਾ ਅਤੇ ਅੱਗੇ ਵੱਧ ਕੇ ਆਪਣੀ ਗਲਤੀਆਂ ਤੋਂ ਸਿੱਖਣਾ ਚਾਹੀਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ